ਪੰਜਾਬ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਪੰਜਾ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਪੰਜਾਬ ਦਾ ਵਿੱਚ ਕ ਜਿਹੜਾ ਪੰਜਾਬੀ ਭੰਗੜਾ ਨਾ ਕਰੇ ਉਸਨੂੰ ਪੰਜਾਬੀ ਨਹੀਂ ਮੰਨਿਆ ਜਾਂਦਾ ਅਤੇ ਜਿੱਥੇ ਜਿੱਥੇ ਲੋਕ ਪੰਜਾਬੀ ਗਏ ਨੇ ਉਨ੍ਹਾਂ ਨੇ ਭੰਗੜੇ ਨੂੰ ਬਹੁਤ ਹੀ ਅੱਗੇ ਵਧਾਇਆ ਹੈ ਸਾਰੇ ਦੇਸ਼ਾਂ ਵਿੱਚ ਭੰਗੜੇ ਨੂੰ ਬਹੁਤ ਹੀ ਮਨਪਸੰਦ ਲੋਕ ਨਾਚ ਮੰਨਿਆ ਜਾਂਦਾ ਹੈ